ਹੈਲੋ ਵਧੀਆ ਜੀ ਵਧੀਆ ਤੁਸੀਂ ਸੁਣਾਓ ਹਾਂ ਹਾਂਜੀ ਵੀਰੇ ਬਸ ਕੁਝ ਨਹੀਂ ਤੁਸੀਂ ਕੌਣ ਬੋਲਦੇ ਉ ਜੀ

ਹਾਂਜੀ ਹਾਂਜੀ ਹਾਂਜੀ ਮਸ਼ਹੂਰ ਤਾਂ ਚਲੋ ਇੱਥੇ ਇੱਕ ਤਾਂ ਮੇਨ ਆਪਣੇ ਧਾਰਮਿਕ ਸਥਾਨ ਆ ਜੀ ਆਪਣੇ ਗੁਰਦੁਆਰੇ ਨੇ ਆਪਣੇ ਫਤਿਹਗੜ੍ਹ ਸਾਹਿਬ ਇੱਕ ਤਾਂ ਮੇਨ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਇੱਕ ਜੋਤੀ ਸਰੂਪ ਗੁਰਦੁਆਰਾ ਏ ਇੱਕ ਬਾਬਾ ਮੋਤੀ ਰਾਮ ਮਹਿਰਾ ਗੁਰਦੁਆਰਾ ਹੈ ਇੱਕ ਰੋਜ਼ਾ ਸ਼ਰੀਫ ਹੈ ਇੱਥੇ ਅਤੇ ਇੱਕ ਉਸ ਤੋਂ ਬਾਅਦ ਮੁਗਲਾਂ ਦੇ ਰਾਜ ਦਾ ਨਾ ਇੱਕ ਉਹ ਬਣਿਆ ਹੋਇਆ ਮਹਿਲ ਜਿਹਾ ਉਹ ਹੁਣ ਉਹਨੂੰ ਆਮ ਖਾਸ ਬਾਗ ਕਹਿਦੇ ਹਾਂ ਉਹਨੂੰ ਹੁਣ ਅਤੇ ਇੱਕ ਉਹ ਬਹੁਤ ਫੇਮਸ ਜਗ੍ਹਾਂ ਹੈ ਆਪਣੇ ਇੱਥੇ ਘੁੰਮਣ ਲਈ ਹਾਂਜੀ ਹਾਂਜੀ ਸਾਰਾ ਇੰਤਜ਼ਾਮ ਹੈਗਾ ਆਪਣੇ ਕੋਲ ਗੱਡੀ ਦਾ ਹਾਂਜੀ ਕੋਈ ਗੱਲ ਨਹੀਂ ਵੀਰੇ ਫੈਮਿਲੀ ਨਾਲ ਆ ਜਿਓ ਫੀਸ ਵੀਰੇ ਕੋਈ ਗੱਲ ਨਹੀਂ ਤੁਸੀਂ ਆਓ ਇੱਥੇ ਆਪਾਂ ਬੈਠ ਕੇ ਕਰਲਾਂਗੇ ਗੱਲਬਾਤ ਸਾਰੀ ਉਹ ਜੋ ਵੀ ਫੀਸ ਹੋਊਗੀ ਆਪਾਂ ਘੱਟ ਵੱਧ ਜੋ ਵੀ ਹੋਊਗਾ ਹਾਂ ਹਾਂਜੀ ਉਹ ਬੈਠ ਕੇ ਆਪਾਂ ਨਿਪਟਾਲਾਗੇ ਆਉਣਾ ਆਉਣਾ ਕਦੋਂ ਆ ਤੁਸੀਂ ਠੀਕ ਆ ਵੀਰੇ ਚਲੋ ਜਿੱਦਾਂ ਵੀ ਹੋਇਆ ਮੇਰੇ ਕੋਲ ਤੁਡ ਮੇਰੇ ਕੋਲ ਨੰਬਰ ਤੁਹਾਡਾ ਆ ਗਿਆ ਮੈਨੂੰ ਫੋਨ ਕਰ ਲਿਓ ਤੁਸੀਂ ਜਿੱਦਾਂ ਵੀ ਹੋਇਆ ਤੁਸੀਂ ਆਉਣਾ ਹੋਇਆ ਮੈਨੂੰ ਪਹਿਲਾਂ ਫੋਨ ਕਰ ਦਿਓ ਹਾਂ ਇੱਕ ਦਿਨ ਪਹਿਲਾਂ ਫੋਨ ਕਰ ਦਿਓ ਮੈਨੂੰ ਠੀਕ ਹੈ ਵੀਰੇ ਓਕੇ ਜੀ